ਸਤਿ ਸ਼੍ਰੀ ਅਕਾਲ ਜੀ ਮੈਂ ਕਪੂਰ ਕਪੂਰਥਲੇ ਤੋਂ ਗੱਲ ਕਰ ਰਿਹਾ ਹੈ ਮੈਂ ਕਪੂਰਥਲੇ ਤੋਂ ਮਦਰਾਸ ਜਾਣਾ ਚਾਹੁੰਦਾ ਹਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਹਾਂ ਕਿ ਛੱਬੀ ਤਰੀਕ ਨੂੰ ਛੱਬੀ ਅਗਸਤ ਨੂੰ ਕੋਈ ਵੀ ਏ ਸੀ ਕਲਾਸ ਅ ਕੰਪਾਰਟਮੈਂਟ ਪਿੱਛੇ ਕੋਈ ਸੀਟ ਖਾਲੀ ਹੈ ਜਿਵੇਂ ਕਿ ਮੈਂ ਦੇਖ ਰਿਹਾ ਹਾਂ ਨੈੱਟ 'ਤੇ ਆਪਣੇ ਇੱਕ ਸੀਟ ਖਾਲੀ ਸ਼ੋਅ ਹੋ ਰਹੀ ਹੈ ਅਤੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੈਨੂੰ ਇਹ ਸੀਟ ਮਿਲ ਸਕਦੀ ਹੈ ਅਤੇ ਜੇ ਮਿਲ ਸਕਦੀ ਹੈ ਤਾਂ ਕੀ ਇਸਦਾ ਚਾਰਜਸ ਕਿਆ ਕਿਆ ਹੋਵੇਗਾ ਅਤੇ ਇਹਦੇ ਵਿੱਚ ਕਿਆ ਕਿਆ ਇੰਕਲੀਡ ਹੋਵੇਗਾ ਮੇਰੇ ਖਾਣ ਪੀਣ ਲਈ ਅਤੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕੀ ਦਿਲ ਕਲਕੱਤਾ ਤੋਂ ਸੋਰੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਪੂਰਥਲੇ ਤੋਂ ਮਦਰਾਸ ਜਾਣ ਲਈ ਕਾਫੀ ਲੰਬਾ ਸਫ ਸਫ਼ਰ ਹੈ ਅਤੇ ਉਹ ਸਫ਼ਰ ਵਿੱਚ ਇੱਕ ਕੰਫਰਟ ਲੈਵਲ ਦਾ ਹੋਣਾ ਕਾਫੀ ਜ਼ਰੂਰੀ ਹੈ ਅਤੇ ਇੰਨਾ ਲੰਬਾ ਸਫ਼ਰ ਖੜ੍ਹੇ ਹੋ ਕੇ ਜਾਂ ਬਹਿ ਕੇ ਇੱਕ ਥਾਂ ਨਹੀਂ ਪੋਸੀਬਲ ਮੇਰੇ ਲਈ ਮੈਨੂੰ ਇੱਕ ਵਧੀਆ ਕੰਬਲ ਚਾਹੀਦੇ ਹੈ ਇਹਦੇ ਪਰ ਗੱਦੇ ਚਾਹੀਦੇ ਹੈ ਤਾਂ ਕਿ ਮੈਂ ਆਪਣੀ ਯਾਤਰਾ ਵਧੀਆ ਬਣਾ ਸਕਾਂ ਧੰਨਵਾਦ ਜੀ